ਸਾਡੇ ਆਲੇ ਦੁਆਲੇ ਕਈ ਤਰ੍ਹਾਂ ਦੇ ਛੋਟੇ ਅਤੇ ਵੱਡੇ ਕਾਰੋਬਾਰ ਹਨ ਜਿਵੇਂ ਛੋਟੇ ਕਾਰੋਬਾਰ ਤੁਸੀਂ ਲਾ ਲਓ ਮਨਿਆਰੀ ਦੀ ਸ਼ੋਪ ਹੋ ਗਈ ਕਰਿਆਨੇ ਦੀ ਦੁਕਾਨ ਹੋ ਗਈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਵੇਂ ਸਟੀਵ ਸ਼ਾਪ ਹੋ ਗਈ ਛੋਟੇ ਪੱਧਰ ਦੀ ਹੋ ਗਈ ਇਸ ਤਰ੍ਹਾਂ ਦੇ ਛੋਟੇ ਕਾਰੋਬਾਰ ਹਨ ਪਰ ਮੇਰੇ ਜਿਹਦੇ 'ਤੇ ਦਿਲਚਸਪੀ ਆਪਣੀ ਆ ਉਹ ਮੇਰਾ ਆਪਣਾ ਖੁਦ ਦਾ ਕਾਰੋਬਾਰ ਹੈ ਜੋ ਕਿ ਮੈਂ ਆਪ ਹੈਂਡਲ ਕਰਦਾ ਹਾਂ ਅਤੇ ਆਪ ਹੀ ਮੈਂ ਉਹਨੂੰ ਵੇਖਦਾ ਹਾਂ ਉਹ ਮੇਰਾ ਕਾਰੋਬਾਰ ਹੈ ਸਵੀਟ ਸ਼ਾਪ ਜੋ ਅਸੀਂ ਖੁਦ ਤਿਆਰ ਕਰੀਦੀ ਹੈ ਅਤੇ ਖੁਦ ਵੇਚੀ ਦੀ ਹੈ ਇਹਦੇ 'ਤੇ ਅਸੀਂ ਕਾਫ਼ੀ ਸਮਾਨ ਅਸੀਂ ਖੁਦ ਤਿਆਰ ਕਰਦੇ ਹਾਂ ਜਿਵੇਂ ਕਿ ਸਾਡੀ ਬਰਫੀ ਬਹੁਤ ਮਸ਼ਹੂਰ ਹੈ ਸਾਡੇ ਇਲਾਕੇ ਦੀ ਬਾਕੀ ਅਸੀਂ ਫਾਸਟ ਫੂਡ ਦਾ ਵੀ ਅਸੀਂ ਕੰਮ ਕਰੀਦਾ ਹੈ ਉਹ ਵੀ ਅਸੀਂ ਨਾਲ ਹੀ ਖੂਬ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਹਾਂ ਕਿ ਹਰ ਇੱਕ ਜੋ ਵੀ ਅਸੀਂ ਚੀਜ਼ ਤਿਆਰ ਕਰੀਏ ਵਧੀਆ ਹੋਵੇ ਧੰਨਵਾਦ